ਮੋਹਾਲੀ ਜ਼ਿਲ੍ਹੇ ਵਿੱਚ ਮੇਨ ਕਰਕੇ ਤਿੰਨ ਤਰ੍ਹਾਂ ਦੇ ਵਿਕਲ ਵਿਕਲਪ ਹਨ ਜਿਸ ਵਿੱਚ ਸੜਕਾਂ ਰੇਲਵੇ ਅਤੇ ਹਵਾਈ ਅੱਡਾ ਆ ਜਾਂਦਾ ਹੈ ਅਤੇ ਇੱਥੇ ਦੀ ਇੱਥੇ ਮੋਹਾਲੀ ਜ਼ਿਲ੍ਹੇ ਵਿੱਚ ਇੱਕ ਜੋ ਰੇਲ ਅੱਡਾ ਹੈ ਉਹ ਭਾਰਤ ਦੇ ਮੁੱਖ ਸ਼ਹਿਰਾਂ ਨਾਲ ਜੁੜਿਆ ਹੈ ਉੱਥੋਂ ਸਾਰੇ ਸ਼ਹਿਰਾਂ ਵਾਸਤੇ ਟਰੇਨਾਂ ਜਾਂਦੀਆਂ ਹਨ ਅਤੇ ਜੋ ਕਿ ਹਵਾਈ ਅੱਡਾ ਹੈ ਉੱਥੋਂ ਇੰਟਰਨੈਸ਼ਨਲ ਫਲੈਟਾਂ ਵੀ ਜਾਂਦੀਆਂ ਹਨ ਅਤੇ ਬਾਕੀ ਹੋਰ ਭਾਰਤ ਦੇ ਮੇਨ ਜੋ ਬੜੇ ਸ਼ਹਿਰ ਨੇ ਬੰਬੇ ਦਿੱਲੀ ਕਲਕੱਤਾ ਉਨ੍ਹਾਂ ਲਈ ਵੀ ਫਲੈਟਾਂ ਜਾਂਦੀਆਂ ਹਨ ਅਤੇ ਉੱਥੇ ਦਾ ਜਿਹੜਾ ਮੇਨ ਜੋ ਕਿ ਮੇਨ ਇੱਥੇ ਦੀ ਪਬਲਿਕ ਵਾਸਤੇ ਜੋ ਕਿ ਵਿਕਲਪ ਹੈ ਉਹ ਹੈਗਾ ਸੜਕ ਇੱਥੇ ਸੜਕਾਂ ਬਹੁਤ ਵਧੀਆ ਬਣਾਈਆਂ ਹੋਈਆ ਨੇ ਸਰਕਾਰ ਨੇ ਵਟ ਕਈ ਵਾਰ ਸਾਨੂੰ ਟਰੈਫਿਕ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇੱਥੇ ਸਰਕਾਰੀ ਬੱਸਾਂ ਸਰਕਾਰੀ ਬੱਸ ਅੱਡਾ ਵੀ ਹੈ ਜਿੱਥੋਂ ਹਰ ਸ਼ਹਿਰ ਵਾਸਤੇ ਬੱਸਾਂ ਜਾਂਦੀਆਂ ਹਨ ਇੱਥੇ ਟੈਕਸੀ ਸਰਵਿਸ ਵੀ ਹੈਗੀ ਹੈ ਜਿਸ ਵਿੱਚ ਓਲਾ ਊਬਰ ਵਰਗੀਆਂ ਕੰਪਨੀਆਂ ਕੰਮ ਕਰਦੀਆਂ ਹਨ